ਹੈਲੋ ਹੋਰ ਜੀ ਠੀਕ ਹੋ ਸਤਿ ਸ਼੍ਰੀ ਅਕਾਲ ਠੀਕ ਹੈ ਠੀਕ ਹੈ ਹੋਰ ਸਾਰੇ ਠੀਕ ਠਾਕ ਘਰੇ ਚਲੋ ਵਧੀਆ ਹੀ ਚਾਹੀਦਾ ਹੋਰ ਬਣਾ ਲਿਆ ਖਾ ਲਿਆ ਖਾਣਾ ਖੁਣਾ ਬਸ ਬੈਠੀ ਸੀ ਮੇਰੇ ਦਿਮਾਗ ਵਿੱਚ ਇਹੋ ਆਈ ਸੀ ਵੀ ਜਿਹੜਾ ਆਪਣੇ ਗਲੀ 'ਚ ਟੋਆ ਹੈ ਵੀ ਹਾਂ ਹਾਂਜੀ ਠੀਕ ਹੈ ਠੀਕ ਹੈ ਵਧੀਆ ਅਤੇ ਜਿਹੜਾ ਉਹ ਟੋਆ ਹਾਂਜੀ ਹਾਂ ਬਚੇ ਹੈ ਅਤੇ ਟੋਆ ਆਪਾਂ ਉਹਦੇ ਬਾਰੇ ਮੈਂ ਗੱਲ ਕਰਨੀ ਸੀ ਵੀ ਆਪਾਂ ਨੂੰ ਸਾਰਿਆਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ ਹੈ ਨਾ ਹਾਂ ਹਾਂ ਹਾਂ ਜਿਹੜਾ ਮੀਂਹ ਨਾਲ ਤਾਂ ਫਿਰ ਭਰ ਜਾਂਦਾ ਜਦੋਂ ਪਾਣੀ ਵਗੈਰਾ ਉਦੋਂ ਆਪਾਂ ਨੂੰ ਕਾਫੀ ਦਿੱਕਤ ਆਉਂਦੀ ਆ ਹਾਂ ਜਦੋਂ ਕੋਈ ਆਪਣੇ ਵਹੀਕਲ ਵਗੈਰਾ ਲੰਘਾਉਦਾ ਨਾ ਹਮ ਹਮ ਜਦੋਂ ਕੋਈ ਸਾਧਨ ਵਗੈਰਾ ਆਪਾਂ ਗੱਡੀ ਗੁੱਡੀ ਵੀ ਹਾਂਜੀ ਹਾਂਜੀ ਤਾਂ ਮੈਂ ਉਹਦੇ ਬਾਰੇ ਗੱਲ ਕਰਦੀ ਸੀ ਮੈਂਖਾਂ ਵੀ ਤਾਂ ਵੀ ਚਲੋ ਆਪਾਂ ਸਾਰੇ ਗਲੀ 'ਚ ਵਧੀਆ ਹਾਂ ਵੀ ਕਿਉਂਕਿ ਇਹ ਤਾਂ ਦੇਖੋ ਆਪਣੀ ਗਲੀ ਦਾ ਸਾਂਝਾ ਤਾਂ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਹੀ ਕਰਨਾ ਪੈਣਾ ਹੈ ਨਾ ਕਿਉਂਕਿ ਦਿੱਕਤਾਂ ਤਾਂ ਸਾਰਿਆਂ ਨੂੰ ਹੀ ਹੈ ਸੋ ਆਪਣੇ ਜਦੋਂ ਵੀਕਲ ਟੱਪਦੇ ਹਾਂ ਜਾਂ ਕੋਈ ਆਪਣੇ ਬਜ਼ੁਰਗ ਆ ਜਦੋਂ ਟੱਪਦੇ ਉਹਨਾਂ ਨੂੰ ਵੀ ਦਿੱਕਤਾਂ ਆਉਂਦੀਆਂ ਅਤੇ ਛੋਟੇ ਛੋਟੇ ਬੱਚੇ ਆ ਜਦੋਂ ਹੈ ਨਾ ਖੇਡਦੇ ਖੁਡਦੇ ਗਲੀ 'ਚ ਤਾਂ ਉਹ ਵੀ ਵਿਚਾਰੇ ਕਈ ਵਾਰੀ ਡਿੱਗ ਡੁੱਗ ਵਿੱਚ ਪੈਣ ਨਾ ਜਾਣੀ ਹੈ ਨਾ ਤਾਂ ਇਹਦੇ ਕਰਕੇ ਹਾਂਜੀ ਹਾਂ ਅਤੇ ਹੋਰ ਹੋਰ ਅਤੇ ਤਾਂ ਹੀ ਮੈਨੂੰ ਵੀ ਐਂਏ ਆ ਵੀ ਚਲੋ ਬੱਚਿਆਂ ਨੂੰ ਆਪਦਾ ਹਾਂ ਪਤਾ ਨਹੀਂ ਲੱਗਦਾ ਉਹੀ ਤਾਂ ਵੀ ਨੁਕਸਾਨ ਤਾਂ ਜੇ ਆਪਣੀ ਗਲੀ 'ਚੋਂ ਕਿਸੇ ਦਾ ਵੀ ਹੈ ਨੁਕਸਾਨ ਤਾਂ ਨੁਕਸਾਨ ਹੀ ਹੈ ਫਿਰ ਜੇ ਕੋਈ ਡਿੱਗਦਾ ਵੀ ਹੈ ਨਾ ਸੱਟ ਸਪੇਟਕ ਵੱਜਦੀ ਹੈ ਕੋਈ ਬੱਚੇ ਨੂੰ ਵੱਜਦੀ ਜਾਂ ਕਿਸੇ ਬਜ਼ੁਰਗ ਨੂੰ ਜਾਂ ਨੋਰਮਲੀ ਕੋਈ ਵੀ ਕਲਾ ਲਈ ਮੰਨ ਲਓ ਡਿੱਗ ਪਿਆ ਹੈ ਨਾ ਅਤੇ ਅਤੇ ਮੈਂ ਇਸੇ ਕਰਕੇ ਕੀਤੀ ਸੀ ਵੀ ਆਪਾਂ ਕੁਝ ਕਰੀਏ ਹੈ ਨਾ ਉਹਦੇ ਬਾਰੇ ਤਾਂ ਸਾਰੇ ਹਾਂ ਸਾਰੇ ਰਲ ਕੇ ਉਹਦੇ ਬਾਰੇ ਹਾਂ ਹਾਂ ਹਾਂ ਤੁਸੀਂ ਵੀ ਆਪਦੇ ਹਸਬੈਂਡ ਨੂੰ ਵਗੈਰਾ ਨਾਲ ਵੀ ਤੁਸੀਂ ਵੀ ਜਿਵੇਂ ਆਪਦੇ ਹਸਬੈਂਡ ਨਾਲ ਗੱਲ ਕਰਿਓ ਹੈ ਨਾ ਕਿਉਂਕਿ ਥੋੜ੍ਹਾ ਜਿਹਾ ਇਸ ਕੰਮ 'ਚ ਦਾ ਇਹ ਵੀ ਜੈਂਟਸ ਅੱਗੇ ਹੋਣਗੇ ਤਾਂ ਫਿਰ ਹੀ ਆ ਹੈ ਨਾ ਹਾਂਜੀ ਹਾਂਜੀ ਹੋਰ ਕਰਦੇ ਹੈਗੇ ਹਾਂ ਕਿਉਂਕਿ ਰਲ ਮਿਲ ਕੇ ਇਕੱਠਿਆਂ ਨਾਲ ਹੀ ਹੁੰਦਾ ਇੱਕ ਤਾਂ ਜਣਾ ਤੁਹਾਨੂੰ ਪਤਾ ਕੋਈ ਵੀ ਫਿਕ ਅਗਲਾ ਕਹਿੰਦਾ ਮੇਰੀ ਕਿਹੜਾ ਮੈਨੂੰ ਕਿ ਜ਼ਿਆਦਾ ਦਿੱਕਤ ਆ ਜੇ ਬਾਕੀਆਂ ਨੂੰ ਨਹੀਂ ਹੈ ਨਾ ਇਹ ਵੀ ਗੱਲ ਹੋ ਜਾਂਦੀ ਹੈ ਫਿਰ ਹੈ ਨਾ ਅਗਲਾ ਕਹਿ ਹੀ ਦਿੰਦਾ ਹਾਂ ਨਾਲੇ ਦੇਖੋ ਗਲੀ ਹਾਂ ਗਲੀ ਸਾਰਿਆਂ ਦੀ ਸਾਂਝੀ ਓ ਹੀ ਹੈ ਦੇਖੋ ਹਾਂ ਸਾਰਿਆਂ ਨੇ ਹਾਂਜੀ ਹਾਂਜੀ ਅਤੇ ਹਾਂਜੀ ਹਾਂਜੀ ਉਹੀ ਤਾਂ ਪਾਣੀ ਹਾਂ ਹਾਂ ਹੋਰ ਚਲੋ ਹਾਂ ਠੀਕ ਹੈ ਤੁਸੀਂ ਹੈ ਨਾ ਕਰ ਲਿਓ ਗੱਲ ਹੈ ਨਾ ਚਲੋ ਓਕੇ ਜੀ ਠੀਕ ਹੈ ਫਿਰ ਹੈ ਨਾ ਓਕੇ ਜੀ